ਪੰਜਾਬ ਵਿਚ ਲੋਕ ਆਪਣੇ ਸੱਭਿਆਚਾਰ ਵਿਰਾਸਤ ਨੂੰ ਜਿਵੇਂ ਭੰਗੜੇ ਰਾਹੀਂ ਗਿੱਧੇ ਰਾਹੀਂ ਅਤੇ ਪੋਲਟਰੀਸ ਸਕਿੱਟਾਂ ਵਗੈਰਾ ਸਕਿੱਟਾਂ ਦੇ ਨਾਲ ਕਰਦੇ ਆ ਅੱਗੇ ਲੈ ਕੇ ਆਉਂਦੇ ਵੀ ਬਣਾਉਂਦੇ ਜਿਵੇਂ ਬੱਚਿਆਂ ਨੂੰ ਸਕੂਲਾਂ ਵਿੱਚ ਫੰਕਸ਼ਨ ਹੁੰਦੇ ਆ ਅਤੇ ਉਹਦੇ ਵਿੱਚ ਬੱਚੇ ਜਾਂਦੇ ਆ ਜਿਵੇਂ ਸਾਉਣ ਦੇ ਤਿਉਹਾਰ 'ਚ ਬੱਚੇ ਗਿੱਧਾ ਭੰਗੜਾ ਕਰਦੇ ਆ ਅਤੇ ਸਕਿੱਟਾਂ ਸਟੋਰੀਆਂ ਪੋਲਟਰੀਆਂ ਸਿਮ ਕਲਾਸੀਕਲ ਕਰਦੇ ਆ ਉਹ 'ਤੇ ਹਰ ਇੱਕ ਚੀਜ਼ ਬਣਾਉਣੀ ਚਾਹੁੰਦੇ ਜਿੱਦਾਂ ਬੱਚਿਆਂ ਨੂੰ ਹਰ ਇੱਕ ਚੀਜ਼ ਸਕੂਲਾਂ ਸੱਭਿਆਚਾਰ ਪ੍ਰੋਗਰਾਮ ਮਨਾਉਂਦੇ ਉਹ ਜਿਵੇਂ ਪੰਦਰਾਂ ਅਗਸਤ ਦੇ ਉਹਨਾਂ ਦੇ ਸਕੂਲਾਂ 'ਚ ਹੁੰਦਾ ਵਾ ਵਿਸਾਖੀ 'ਤੇ ਹੁੰਦਾ ਲੋਹੜੀ 'ਤੇ ਹੁੰਦਾ ਹਰ ਇੱਕ ਪ੍ਰੋਗਰਾਮ ਇੱਦਾਂ ਮਨਾਉਂਦੇ ਆ ਜਿੱਦਾਂ ਸਾਡੇ ਲੋਹੜੀ ਹੁੰਦੀ ਆ ਅਸੀਂ ਉਦੋਂ ਲੋਹੜੀ 'ਤੇ ਭੰਗੜਾ ਪਾਉਂਦੇ ਹਾਂ ਅਤੇ ਲੋਹੜੀ 'ਤੇ ਪਾਉਂਦੇ ਹਾਂ ਅਤੇ ਸਾਉਣ ਦੇ ਤਿਉਹਾਰ 'ਚ ਕੁੜੀਆਂ ਸਾਡੇ ਸਾਵੇਂ ਲਾਉਂਦੀਆਂ ਵਾ ਗਿੱਧਾਂ ਪਾਉਂਦੀਆਂ ਵਾ ਹਰ ਇੱਕ ਕੰਮ ਇੱਥੇ ਪੂੜੇ ਮਾਲ ਪੂੜੇ ਬਣਦੇ ਇਵੇਂ ਚੀਜ਼ਾਂ ਬਣਾ ਕੇ ਅਤੇ ਉਹਨੂੰ ਇੱਦਾਂ ਮਨਾਉਂਦੇ ਹਾਂ ਜਿਵੇਂ ਆਪਣੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਉਹਨਾਂ ਨੇ ਵੀ ਹਰ ਇੱਕ ਗੁੜ ਵਾਲੇ ਪੂੜੇ ਬਣਦੇ ਦੂਸਰੇ ਪੂੜੇ ਬਣਦੇ ਆ ਖੰਡ ਵਾਲੇ ਅਤੇ ਇਹਦੇ ਨਾਲ ਅਸੀਂ ਇੱਦਾਂ ਹੀ ਆਪਣੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਜਿਵੇਂ ਇੱਦਾਂ ਮਨਾਉਂਦੇ ਹਾਂ ਲੋਕ ਭੰ ਭੰਗੜੇ ਰਾਹੀਂ ਗਿੱਧੇ ਰਾਹੀਂ ਇੱਦਾਂ ਹਰ ਇੱਕ ਚੀਜ਼ ਆਪਣੀ ਘਰ ਵੀ ਭੰਗੜੇ 'ਚ ਆਪਣੀ ਸੱਭਿਆਚਾਰ ਦੀ ਲਿਆ ਕੇ ਅਤੇ ਵਧੀਆ ਤਰੀਕੇ ਨਾਲ ਮਨਾਉਂਦੇ ਹਾਂ